ਬੈਂਕ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਅਨੁਕੂਲ ਕੰਮ ਕਰਨਾ ਕਰਨ ਦੇ ਵਿੱਚ ਮੈਨੂੰ ਕੋਈ ਵੀ ਮੁਸ਼ਕਿਲ ਨਹੀਂ ਆ ਰਹੀ ਹੈ ਪਰ ਜਿਵੇਂ ਕਿ ਸਾਡੀ ਐਲਡਰ ਜਨਰੇਸ਼ਨ ਹੈ ਸਾਡੇ ਮਦਰ ਨੇ ਫਾਦਰ ਨੇ ਗ੍ਰੈਂਡਫਾਦਰ ਨੇ ਉਹਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਡਿਜੀਟਲ ਇੰਡੀਆ ਦਾ ਜ਼ਮਾਨਾ ਹੈ ਸਭ ਕੁਛ ਔਨਲਾਈਨ ਹੋ ਰਿਹਾ ਹੈ ਸਭ ਕੁਛ ਇੰਟਰਨੈਟ ਦੇ ਨਾਲ ਹੋ ਰਿਹਾ ਹੈ ਅਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਜਿਹੜੀ ਜਨ ਐਲਡਰ ਜਨਰੇਸ਼ਨ ਹੈ ਉਸ ਦਾ ਇੰਟਰਨੈਟ ਨੂੰ ਲੈ ਕੇ ਮੋਬਾਈਲ ਨੂੰ ਲੈ ਕੇ ਪੀ ਸੀ ਨੂੰ ਲੈ ਕੇ ਲੈਪਟਾਪ ਨੂੰ ਲੈ ਕੇ ਹੱਥ ਤੰਗ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਨਹੀਂ ਆਉਂਦੀ ਹੈ ਜਿਸ ਨਾਲ ਉਹਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਇੱਕ ਉਦਾਹਰਣ ਹੈ ਕਿ ਅੱਜ ਕੱਲ੍ਹ ਇੰਟਰਨੈਟ ਬੈਂਕਿੰਗ ਯੂਜ ਕਰਦੇ ਹਨ ਲੋਕ ਇੰਟਰਨੈਟ ਬੈਂਕਿੰਗ ਯੂਜ ਕਰਨ ਵਾਸਤੇ ਤੁਹਾਨੂੰ ਮੋਬਾਈਲ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਨੀ ਪੈਂਦੀ ਹੈ ਆਨਲਾਈਨ ਸਾਈਟ 'ਤੇ ਜਾ ਕੇ ਬੈਨੀਫਿਸ਼ਰੀ ਡਿਟੇਲਸ ਪਾ ਕੇ ਫਿਰ ਪੇਮੈਂਟ ਅੱਗੇ ਹੁੰਦੀ ਹੈ ਜੋ ਕਿ ਐਲਡਰ ਜਨਰੇਸ਼ਨ ਵਾਸਤੇ ਕਾਫ਼ੀ ਮੁਸ਼ਕਿਲ ਹੈ ਅਤੇ ਉਹ ਇਸ ਦੀ ਵਰਤੋਂ ਦਾ ਲਾਭ ਨਹੀਂ ਲੈ ਸਕਦੇ ਹਨ